ਮੇਰੀ ਜੀ ਇੱਛਾ ਤਾਂ ਇਹੀ ਹੈ ਕਿ ਮੈਂ ਇੱਕ ਚੰਗੀ ਮਾਂ ਇੱਕ ਚੰਗੀ ਅਧਿਆਪਕ ਇੱਕ ਚੰਗੀ ਪਤਨੀ ਬਣ ਸਕਾਂ ਜਿਸ ਨੂੰ ਕਿ ਹਰ ਕੋਈ ਮੇਰੀ ਪ੍ਰੇਜ ਕਰੇ ਮੇਰੀ ਸਿਫਤ ਕਰੇ ਮੇਰੇ ਮੇਰੇ ਕਾਰਨ ਕਿਸੇ ਨੂੰ ਕੋਈ ਦੁੱਖ ਨਾ ਪਹੁੰਚੇ ਬਸ ਮੈਂ ਤਾਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੀ ਹਾਂ ਕਿ ਹਰ ਪਲ ਮੈਨੂੰ ਦੂਸਰਿਆਂ ਦੀ ਸੇਵਾ ਕਰਨ ਦਾ ਮੌਕਾ ਮਿਲੇ